ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਦੋ ਹਫ਼ਤੇ ਪਹਿਲਾਂ ਮੇਰੇ ਦਾਦਾ ਜੀ ਅਕਾਲ ਚਲਾਣਾ ਕਰ ਗਏ ਹਨ ਮੈਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਸਹੀ ਢੰਗ ਨਾਲ ਦਰਜ ਨਹੀਂ ਕੀਤੀ ਗਈ ਹੈ ਮੈਂ ਇਸ ਗੱਲ ਦੀ ਪੁਸ਼ਟੀ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਮੌਤ ਦਾ ਰਿਕਾਡ ਅਧਿਕਾਰਿਤ ਪ੍ਰਣਾਲੀ ਵਿੱਚ ਮੌਜੂਦ ਹੈ ਜਾਂ ਨਹੀਂ ਜੋ ਕਿ ਕਾਨੂੰਨ ਤੌਰ 'ਤੇ ਹੋਣਾ ਲਾਜ਼ਮੀ ਹੈ ਉਨ੍ਹਾਂ ਦੀ ਮੌਤ ਦੀ ਰਜਿਸਟਰੇਸ਼ਨ ਬਹੁਤ ਜ਼ਰੂਰੀ ਹੈ ਤਾਂ ਜੋ ਮੇਰੇ ਦਾਦਾ ਜੀ ਕੁਝ ਪੈਨਸ਼ਨ ਦੇ ਅਧਿਕਾਰੀ ਬਣ ਸਕਣ ਸਾਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ ਜੋ ਕਿ ਦਾਦਾ ਜੀ ਦੇ ਇਲਾਜ ਦੌਰਾਨ ਸਾਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੇ ਦਾਦਾ ਦਾਦੀ ਜੀ ਦੇ ਵਿਧਵਾ ਪੈਨਸ਼ਨ ਨਾਲ ਸਾਡੀ ਬਹੁਤ ਮਦਦ ਹੋ ਜਾਵੇਗੀ ਅਤੇ ਹੋਰ ਵੀ ਬਹੁਤ ਕਾਰਨਾਂ ਲਈ ਰਜਿਸਟਰੇਸ਼ਨ ਜ਼ਰੂਰੀ ਹੈ ਕਿਉਂਕਿ ਕਾਨੂੰਨੀ ਕਾਗਜਾਂ ਵਿੱਚ ਇਹ ਹੋਣਾ ਲਾਜ਼ਮੀ ਹੈ ਅਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਹੈ ਕਿ ਇਸ ਕੰਮ ਲਈ ਤੁਹਾਨੂੰ ਜੋ ਵੀ ਜਾਣਕਾਰੀ ਆ ਕੀ ਹੈ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਾਂਗਾ ਅਤੇ ਇਸ ਲਈ ਜੋ ਵੀ ਸਹਾਇਤਾ ਚਾਹੀਦੀ ਹੋਵੇਗੀ ਉਹ ਮੈਂ ਕਰਾਂਗਾ ਕਿਰਪਾ ਕਰਕੇ ਇਹ ਕੰਮ ਜਿੰਨੀ ਜਲਦੀ ਹੋ ਸਕੇ ਕੀਤਾ ਜਾਵੇ ਧੰਨਵਾਦ